ਹਾਂਜੀ ਨਮਸਕਾਰ ਜੀ ਸਕੂਲ ਸੇ ਬੋਲ ਰਹੇ ਹੈ ਨਮਸਕਾਰ ਮੈਂ ਰਾਹੁਲ ਦਾ ਫਾਦਰ ਬੋਲ ਰਿਹਾ ਜੀ ਸੈਵਨਥ ਏ ਸੈਕਸ਼ਨ ਐਕਚੁਲੀ ਰਾਹੁਲ ਦੇ ਚਾਚੂ ਦੀ ਮੈਰਿਜ ਸੀ ਅਤੇ ਛੁੱਟੀ ਚਾਹੀਦੀ ਸੀ ਮੈਰਿਜ ਵਾਸਤੇ ਕੋਈ ਅੱਠ ਦਿਨ ਵ ਨਹੀਂ ਨਹੀਂ ਇਹਦੇ ਬਿਨਾ ਫਿਰ ਹੋਣਾ ਨਹੀਂ ਨਾ ਮੈਰਿਜ 'ਚ ਬਹੁਤ ਕੰਮ ਹੈਗਾ ਆ ਉਹ ਸਾਰੇ ਹਲਦੀ ਹੁੰਦੀ ਹੈ ਸਾਰਾ ਪ੍ਰੋਗਰਾਮ ਹੈ ਸ਼ਗਨ ਹੈ ਸਾਰੀਆਂ ਚੀਜ਼ਾਂ ਉਹ ਅੱਠ ਦਿਨ ਮਿਨੀਮਮ ਤਾਂ ਚਾਹੀਦੇ ਹੀ ਹੈ ਉਹ ਕਰਵਾ ਲਵਾਂਗਾ ਜੀ ਉਹ ਮੇਰੀ ਰਿਸਪੋਂਸੀਵਿਲਿਟੀ ਹੈ ਸਕੂਲ ਦਾ ਹੋਮਵਰਕ ਕੰਮ ਮੈਂ ਕਰਵਾ ਲੂ ਨਹੀਂ ਇਹਦੇ ਤੋਂ ਬਿਨਾ ਨਹੀਂ ਗੱਲ ਬਣਨੀ ਅੱਠ ਦਿਨ ਵਾਸਤੇ ਬਹੁਤ ਜ਼ਰੂਰੀ ਹੈ ਹਾਂਜੀ ਕੋਈ ਨਹੀਂ ਇਹ ਮੇਰੀ ਰਿਸਪੋਂਸੀਵਿਲਿਟੀ ਜੀ ਠੀਕ ਹੈ ਜੀ ਥੈਂਕ ਯੂ ਜੀ